ਹਲ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ

ਇੱਥੇ ਖਾਣਾ ਪੀਣਾ ਇੱਥੇ ਨੋਰਮਲ ਹੀ ਆ ਜਿਵੇਂ ਕਿ ਰਾਜਮਾਂਹ ਚੌਲ ਆ ਸਾਗ ਆ ਜੀ ਮੱਕੀ ਦੀ ਰੋਟੀ ਇਹੋ ਜਿਹੀ ਚੀਜ਼ਾਂ ਖਾਦੀਆਂ ਜਾਂਦੀਆਂ ਇੱਥੇ ਤੇ ਜਾਂ ਇੱਥੇ ਇੱਥੇ ਖੇ ਖੇਤ ਖੂਤ ਆ ਵੇਖਣ ਵਾਲੇ ਜਾਂ ਧਾਰਮਿਕ ਜਗ੍ਹਾ ਆ ਜਿੱਦਾਂ ਦਰਬਾਰ ਸਾਹਿਬ ਅੰਮ੍ਰਿਤਸਰ ਗੋਲਡਨ ਟੈਂਪਲ ਲ ਹੋਰ ਵੀ ਅੰਮ੍ਰਿਤਸਰ ਜਲ੍ਹਿਆਂਵਾਲਾ ਬਾਗ ਹਾਂਜੀ ਐਦਾਂ ਦੇ ਕਾਫ਼ੀ ਮੰਦਿਰ ਹੈਗੇ ਆ ਇੱਥੇ ਜਿਵੇਂ ਲੇਡੀਜ਼ ਆ ਉਹ ਸੂਟ ਪਾਉਂਦੇ ਆ ਅਤੇ ਜਿਹੜੇ ਜੈਂਟਸ ਆ ਉਹ ਜ਼ਿਆਦਾਤਰ ਪਜ਼ਾਮੇ ਕੁੜਤੇ ਇਹੋ ਜਿਹੇ ਕੱਪੜੇ ਪਾ ਕੇ ਘੁੰਮਦੇ ਆ ਹਾਂਜੀ ਇ ਇੱਥੇ ਇਹੋ ਜਿਹਾ ਸਾਰੇ ਹੀ ਠੀਕ ਆ ਸਾਰੇ ਨੋਰਮਲ ਹੈਗੇ ਆ ਇੱਥੇ ਹਰ ਹਾਂਜੀ ਹਰ ਜਗ੍ਹਾ ਠੀਕ ਆ ਜ਼ਿਆਦਾ ਮਹਿੰਗੇ 'ਚ ਮਹਿੰਗੇ ਬਾਹਰ ਬਾਹਰ ਆ ਸ਼ਹਿਰ ਦੇ ਵਿੱਚ ਸਾਰੇ ਸਸਤੇ ਸਸਤੇ ਹੀ ਆ ਢਾਬੇ ਢੁਬੇ ਜਿਹੜੇ ਹੈਗੇ ਆ ਉੱਥੋਂ ਵਧੀਆ ਰੋਟੀ ਮਿਲ ਜਾਂਦੀ ਆ ਕੱਪੜੇ ਦੱਸਿਆ ਕਿ ਉਹ ਲੇਡੀਜ਼ ਪੰਜਾਬੀ ਸੂਟ ਪਾਉਂਦੇ ਆ ਜਿਵੇਂ ਸਲਵਾਰ ਕਮੀਜ਼ ਅਤੇ ਜਿਹੜੇ ਜੈਂਟਸ ਆ ਉਹ ਪਾਉਂਦੇ ਆ ਪੈਂਟ ਜਿਹੜੇ ਪਜਾਮੇ ਕੁੜਤੇ ਪੈਂਟਾਂ ਸ਼ਰਟਾਂ ਨੌਰਮਲ ਜ਼ਿਆਦਾਤਰ ਪਜਾਮੇ ਕੁੜਤੇ ਹੀ ਪਾਉਂਦੇ ਆ ਕਾਫ਼ੀ ਆ ਇੱਥੇ ਇੱਥੇ ਬਟਾਲੇ ਬਾਬਾ ਜੀ ਦਾ ਵਿਆਹ ਹੁੰਦਾ ਲੇਕਿਨ ਚੱਲੋ ਅੱਜ ਅੱਜ ਕੱਲ੍ਹ ਤਾਂ ਨਹੀਂ ਹੈਗਾ ਲੇਕਿਨ ਇੱਥੇ ਬਟਾਲੇ ਉਹਨਾਂ ਦਾ ਲੱਗਦਾ ਮੇਲਾ ਲੱਗਦਾ ਹੁੰਦਾ ਹੋਰ ਕਈ ਜਗ੍ਹਾ ਜਿਵੇਂ ਨਕੋਦਰ ਆ ਉੱਥੇ ਬਾਬਾ ਲਾਡੀ ਸ਼ਾਹ ਦੀ ਜਗ੍ਹਾ ਅਤੇ ਇੱਕ ਬਾਬਾ ਲਾਲ ਬਾਦਸ਼ਾਹ ਜੀ ਜਗ੍ਹਾ ਐਦਾਂ ਦੀਆਂ ਕਾਫ਼ੀ ਜਗ੍ਹਾ ਹੈਗੀਆਂ ਇੱਥੇ ਗੁਰਦਾਸਪੁਰ ਝੂਲਣਾ ਮਹਿਲ ਹੈ ਦੇਖਣ ਵਾਲਾ ਹਾਂਜੀ ਕਾਫ਼ੀ ਇੱਥੇ ਹੈਗੀਆਂ ਜਗ੍ਹਾ ਨਹੀਂ ਨਹੀਂ ਠੀਕ ਹੈ ਇੱਥੇ ਸਾਰਾ ਸਿਸਟਮ ਠੀਕ ਹੈਗਾ ਜੀ ਠੀਕ ਹੈ ਜੀ